ਪੰਜਾਬ ਦੀ ਰਾਜਨੀਤਿਕ ਪ੍ਰਣਾਲੀ ਬਹੁਤ ਵਧੀਆ ਹੈ ਇਸ ਵਿੱਚ ਹਰੇਕ ਕਿਉਂਕਿ ਪੰਜਾਬ ਦੀ ਪੰਜਾਬ ਦੀ ਰਾਜਨੀਤੀ ਵਿੱਚ ਸਾਰਿਆਂ ਨੂੰ ਸੁਤੰਤਰਤਾ ਦਾ ਅਧਿਕਾਰ ਹੈ ਕੋਈ ਵੀ ਵਿਅਕਤੀ ਆਪਣੀ ਵਿਚਾਰਾਂ ਨੂੰ ਪ੍ਰਗਟ ਕਰ ਸਕਦਾ ਹੈ ਤੇ ਜੋ ਸਰਕਾਰਾਂ ਹੁੰਦੀਆਂ ਇਸ ਵਿੱਚ ਉਹਨਾਂ ਨੂੰ ਆਪਣੇ ਕੋਈ ਵੀ ਸਰਕਾਰ ਜਿਵੇਂ ਵਿਰੋਧੀ ਧਿਰ ਤੋਂ ਉਹਨਾਂ ਨੂੰ ਆਪਣੇ ਮਤਲਬ ਵਿਚਾਰਾਂ ਦੇ ਵਿਰੋਧ ਹੋਣ ਦਾ ਖਤਰਾ ਹੁੰਦਾ ਹੈ ਇਸ ਲਈ ਉਹ ਆਪਣੇ ਉਹਨਾਂ ਨੂੰ ਜਵਾਬਦੇਹੀ ਦੇਣੀ ਪੈਂਦੀ ਹੈ ਇਸ ਲਈ ਕੋਈ ਵੀ ਸਰਕਾਰ ਵੀ ਉਹ ਕੁਝ ਵੀ ਉਵੇਂ ਦਾ ਕੰਮ ਨਹੀਂ ਕਰ ਸਕਦੀ ਤੇ ਇਸ ਵਿੱਚ ਜਨਤਾ ਦੀ ਸੁਣਵਾਈ ਹੁੰਦੀ ਹੈ ਲੋਕਾਂ ਨੂੰ ਕੋਈ ਵੀ ਮਤਲਬ ਗਲਤ ਕੰਮ ਜਿਵੇਂ ਸੜਕਾਂ ਤੇ ਪੰਜਾਬ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਲੋਕਾਂ ਦੀ ਸੇਫਟੀ ਵਾਸਤੇ ਇਹ ਸਭ ਕੁਝ ਕੀਤਾ ਗਿਆ ਹੈ ਤਾਂ ਕਿ ਰਸ ਕੋਈ ਵੀ ਐਕਸੀਡੈਂਟ ਰਸਤੇ ਵਿੱਚ ਹੁੰਦਾ ਹੈ ਤਾਂ ਪੁਲਿਸ ਉਸਨੂੰ ਸੰਭਾਲਦੀ ਹੈ ਅਤੇ ਇਸੇ ਤਰ੍ਹਾਂ ਹੀ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਇਸੇ ਕਰਕੇ ਕਿਹਾ ਜਾਂਦਾ ਕੀ ਪੰਜਾਬ ਦੀ ਰਾਜਨੀਤਿਕ ਪ੍ਰਣਾਲੀ ਬਹੁਤ ਵਧੀਆ ਹੈ